ਮੈਂ ਬਹੁਤ ਵਾਰ ਮਹਿਸੂਸ ਕੀਤਾ ਵੀ ਜਿਹੜੀ ਮੇਰੀ ਲੇਖਣ ਲਿਖਤ ਹੁੰਦੀ ਹੈ ਉਹ ਚੰਗੀ ਨਹੀਂ ਹੁੰਦੀ ਪਰ ਮੇਰੇ ਹਸਬੈਂਡ ਮੇਰਾ ਬਹੁਤ ਸਮਰਥਨ ਕਰਦੇ ਨੇ ਉਨ੍ਹਾਂ ਨੂੰ ਮੇਰਾ ਲਿਖਿਆ ਬਹੁਤ ਪਸੰਦ ਆਉਂਦਾ ਉਹ ਮੈਨੂੰ ਪ੍ਰੇਰਿਤ ਕਰਦੇ ਰਹਿੰਦੇ ਨੇ ਕੁਛ ਨਾ ਕੁਛ ਲਿਖਣ ਦੇ ਲਈ ਕਿਉਂਕਿ ਜਦੋਂ ਉਹ ਕੋਈ ਮੇਰੀ ਲੇਖਣ ਦੀ ਤਾਰੀਫ਼ ਕਰਦੇ ਨੇ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਕਿਸੇ ਹੋਰ ਨੂੰ ਚੰਗਾ ਲੱਗੇ ਨਾ ਲੱਗੇ ਪਰ ਉਨ੍ਹਾਂ ਨੂੰ ਮੇਰਾ ਲਿਖਿਆ ਬਹੁਤ ਚੰਗਾ ਲੱਗਦਾ ਹੈ ਅਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਮੈਂ ਲਿਖਦੀ ਹਾਂ ਮੈਂ ਜਦੋਂ ਉਨ੍ਹਾਂ ਨੂੰ ਲਿਖ ਆਪਣਾ ਲਿਖਿਆ ਪੜ੍ਹ ਕੇ ਸੁਣਾਉਂਦੀ ਹਾਂ ਤਾਂ ਉਹ ਬਹੁਤ ਵਧੀਆ ਮਹਿਸੂਸ ਕਰਦੇ ਨੇ ਬਹੁਤ ਵਧੀਆ ਫੀਲ ਕਰਦੇ ਨੇ ਵੀ ਹਾਂ ਵੀ ਤੂੰ ਬਹੁਤ ਵਧੀਆ ਲਿਖਿਆ ਮੈਨੂੰ ਬਹੁਤ ਸਪੋਟ ਮਿਲਦਾ